ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਕਲਾਤਮਕ ਪਰੰਪਰਾਵਾਂ ਜਿਹੜੀਆਂ ਵਾ ਪ੍ਰਚਲਿਤ ਆ ਕਿੱਦਾਂ ਉਹਨਾਂ ਨੇ ਪੰਜਾਬੀ ਭਾਈਚਾਰੇ ਨੂੰ ਇਕੱਠਾ ਕਰਕੇ ਰੱਖਿਆ ਵਾ ਅਤੇ ਇਹ ਸਾਰਾ ਕਿਵੇਂ ਉਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਵਾ ਇਹਦੇ 'ਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਆਹ ਨਾਲ ਸੰਬੰਧਿਤ ਕੁਝ ਕਲਾ ਕਲਾਤਮਕ ਪਰੰਪਰਾਵਾਂ ਜਿਵੇਂ ਕਿ ਆਪਾਂ ਗੱਲ ਕਰ ਸਕਦੇ ਹਾਂ ਜਦੋਂ ਕੁੜੀ ਜਾਂ ਮੁੰਡੇ ਦਾ ਵਿਆਹ ਹੁੰਦਾ ਵਾ ਅਤੇ ਘਰਾਂ ਵਿੱਚ ਵਿਆਹ ਤੋਂ ਪੰਜ ਦਿਨ ਪਹਿਲਾਂ ਸੱਤ ਦਿਨ ਪਹਿਲਾਂ ਗਿਆਰ੍ਹਾਂ ਦਿਨ ਪਹਿਲਾਂ ਜਿਹੜਾ ਵਾ ਇੱਦਾਂ ਗੋਣ ਬਿਠਾਇਆ ਜਾਂਦਾ ਵਾ ਠੀਕ ਹੈ ਗੋਣ ਜਿਹਨੂੰ ਅੱਜ ਕੱਲ੍ਹ ਲੇਡੀ ਸੰਗੀਤ ਕਿਹਾ ਜਾਂਦਾ ਵਾ ਅਤੇ ਇਹ ਜਿਹੜਾ ਗੋਣ ਬਿਠਾਇਆ ਜਾਂਦਾ ਇਹਦੇ ਵਿੱਚ ਜੇ ਕੁੜੀ ਦਾ ਵਿਆਹ ਹੋਵੇ ਤਾਂ ਸੁਹਾਗ ਬੋਲੇ ਜਾਂਦੇ ਆ ਮੁੰਡੇ ਦਾ ਵਿਆਹ ਹੋਵੇ ਤਾਂ ਘੋੜੀਆਂ ਬੋਲੀਆਂ ਜਾਂਦੀਆਂ ਵਾ ਅਤੇ ਸਾਰੀਆਂ ਆਂਢੀ ਗੁਆਂਢੀ ਸਾਰਾ ਸ਼ਰੀਕਾ ਭਾਈਚਾਰਾ ਅਤੇ ਆਪਣੇ ਰਿਸ਼ਤੇਦਾਰ ਜਿਹੜਾ ਵਾ ਰਾਤ ਨੂੰ ਕੰਮ ਕਾਜਾਂ ਤੋਂ ਵਿਹਲੇ ਹੋ ਕੇ ਇਕੱਠੇ ਵਿਆਹ ਵਾਲੇ ਘਰ ਬਹਿੰਦੇ ਆ ਅਤੇ ਬਹਿ ਕੇ ਸਾਰੀਆਂ ਸੁਹਾਣੀਆਂ ਜਿਹੜੀਆਂ ਵਾ ਉਹ ਗਾਉਣਾ ਸ਼ੁਰੂ ਕਰਦੀਆਂ ਵਾ ਸਭ ਤੋਂ ਪਹਿਲਾਂ ਮੁੰਡੇ ਦੇ ਵਿਆਹ 'ਤੇ ਘੋੜੀਆਂ ਗਾਈਆਂ ਜਾਂਦੀਆਂ ਕੁੜੀ ਦੇ ਵਿਆਹ ਸੁਹਾਗ ਗਏ ਜਾਂਦੇ ਇਸ ਤੋਂ ਬਾਅਦ ਜਿਹੜਾ ਵਾ ਉਹ ਕਈ ਤਰ੍ਹਾਂ ਦੇ ਗੋਣ ਟੱਪੇ ਮਾਹੀਏ ਢੋਲੇ ਜਿਹੜੇ ਆ ਉਹ ਗਾਏ ਜਾਂਦੇ ਆ ਅਤੇ ਆਪਣੀਆਂ ਭਾਵਨਾਵਾਂ ਨੂੰ ਜਿਹੜਾ ਵਾ ਉਹ ਪ੍ਰਗਟ ਕੀਤਾ ਜਾਂਦਾ ਵਾ ਸੰਗੀਤਕ ਰੂਪ ਦੇ ਵਿੱਚ ਇੱਕ ਲੈਅ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਆ ਇਨਸਾਨ ਦੇ ਮਨ ਦੇ ਜਿਹੜੇ ਆ ਉਦੋਂ ਪ੍ਰਗਟ ਹੁੰਦੇ ਆ ਜਿਹੜਾ ਟੱਪੇ ਬੋਲਣੇ ਜਾਂ ਗੋਣ ਬੋਲਣੇ ਕਈ ਵਾਰ ਢੋਲਕੀ ਦੇ ਨਾਲ ਵੀ ਬੋਲੇ ਜਾਂਦੇ ਆ ਜੇ ਕਿਤੇ ਢੋਲਕੀ ਦਾ ਪ੍ਰਬੰਧ ਨਾ ਹੋਵੇ ਅਤੇ ਪੁਰਾਣੇ ਸਮੇਂ ਵਿੱਚ ਘਰਾਂ 'ਚ ਗਾਗਰਾਂ ਹੁੰਦੀਆਂ ਸੀ ਗਾਗਰ ਵਜਾ ਕੇ ਜਿਹੜਾ ਸੀ ਉਹ ਗਾਇਆ ਜਾਂਦਾ ਸੀ ਨੱਚਿਆ ਜਾਂਦਾ ਸੀ ਟੱਪਿਆਂ ਜਾਂਦਾ ਬੜੀ ਖੁਸ਼ੀ ਦਾ ਆਪਣੀ ਦਾ ਮਤਲਬ ਜਿਹੜਾ ਵਾ ਉਹ ਪ੍ਰਗਟਾਵਾ ਕੀਤਾ ਜਾਂਦਾ ਸੀ ਅਤੇ ਇੱਥੇ ਸਾਰੀਆਂ ਸੋਹਾਣੀਆਂ ਇਕੱਠੀਆਂ ਹੋ ਕੇ ਇੱਕ ਚੱਕਰ ਬਣਾ ਕੇ ਗੋਲ ਚੱਕਰ ਉਹਦੇ ਵਿੱਚ ਨੱਚਦੀਆਂ ਖੁਸ਼ੀ ਨਾਲ ਆਪਣੇ ਬੋਲੀਆਂ ਪਾਉਂਦੀਆਂ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਇਸ ਤੋਂ ਇਲਾਵਾ ਜਿਵੇਂ ਆਪਾਂ ਕਲਾ ਦੀ ਗੱਲ ਕਰੀਏ ਤਾਂ ਕਲਾ ਜਿਹੜੀ ਚਿੱਤਰਕਾਰੀ ਜਿਹੜੀ ਆ ਉਹਦਾ ਵੀ ਪੰਜਾਬੀ ਸੱਭਿਆ ਵਿੱਚ ਇੱਕ ਅਨਿੱਖੜਵਾਂ ਜਿਹੜਾ ਵਾ ਉਹ ਸਥਾਨ ਆ ਉਹਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ ਕਿਉਂਕਿ ਪੁਰਾਤਨ ਸਮੇਂ 'ਚ ਜਿਹੜੇ ਸੀ ਘਰ ਕੱਚੇ ਹੁੰਦੇ ਸੀ ਵਿਹੜੇ ਕੱਚੇ ਹੁੰਦੇ ਸੀ ਕੰਧਾਂ ਕੱਚੀਆਂ ਹੁੰਦੀਆਂ ਸੀ ਉਹਨਾਂ ਨੂੰ ਜਿਹੜਾ ਸੀ ਉਹ ਲਿੰਬਿਆ ਜਾਂਦਾ ਸੀ ਪੋਚਾ ਫੇਰਿਆ ਜਾਂਦਾ ਸੀ ਅਤੇ ਫਿਰ ਲੈ ਕੇ ਉਹਦੇ 'ਤੇ ਕਈ ਤਰ੍ਹਾਂ ਦੀਆਂ ਕਰੀਤੀਆਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਉਹ ਬਹੁਤ ਹੀ ਜ਼ਿਆਦਾ ਜਿਹੜੀਆਂ ਵਾ ਉਹ ਪਿਆਰੀਆਂ ਲੱਗਦੀਆਂ ਸੀ ਕਈ ਤਰ੍ਹਾਂ ਦੇ ਫੁੱਲ ਬੂਟੇ ਜਿਹੜੇ ਉਹਨਾਂ 'ਤੇ ਪਏ ਜਾਂਦੇ ਜਿਹੜੇ ਪੁਰਾਣੇ ਝੌਂਕੇ ਹੁੰਦੇ ਸੀ ਉਹਨਾਂ ਚੌਂਕਿਆਂ ਦੀਆਂ ਜਿਹੜੀਆਂ ਇਹ ਚਾਰ ਦੀਵਾਰੀ ਕਨਿਆਰੀ ਹੁੰਦੀ ਹੀ ਜਿਹਨੂੰ ਆਪਾਂ ਬਾਉਂਡਰੀ ਕਹਿ ਦਿੰਦੇ ਹਾਂ ਠੀਕ ਹੈ ਉਹਨਾਂ ਨੂੰ ਬਹੁਤ ਸੋਹਣੇ ਕਟਾਂ ਬਣਾ ਬਣਾ ਕੇ ਕਈ ਤਰ੍ਹਾਂ ਦੇ ਡਿਜੈਨ ਬਣਾ ਬਣਾ ਕੇ ਮਿੱਟੀ ਨਾਲ ਜਿਹੜਾ ਵਾ ਉਹ ਬਣਾਇਆ ਜਾਂਦਾ ਸੀ ਤਾਂ ਕਿ ਉਹ ਬੜੀ ਖੂਬਸੂਰਤੀ ਜਿਹੜੀ ਆ ਉਹਨਾਂ ਦੀ ਜਿਹੜੀ ਆ ਉਹ ਝਲਕੇ ਅਤੇ ਇਹ ਪੰਜਾਬੀ ਸੱਭਿਆਚਾਰ ਦਾ ਜਿਹੜਾ ਵਾ ਮਤਲਬ ਕਿ ਕਲਾ ਜਿਹੜੀ ਆ ਉਹ ਘਰ ਘਰ ਵਿੱਚ ਜਿਹੜੀ ਵੱਸਦੀ ਸੀ ਪੰਜਾਬੀ ਸੱਭਿਆਚਾਰ ਵਿੱਚ ਅਤੇ ਲੋਕਾਂ ਦੇ ਵਿਹੜੇ ਕੱਚੇ ਹੁੰਦੇ ਸੀ ਕੱਚੇ ਵੇਹੜਿਆਂ 'ਚ ਪੋਚਾ ਫੇਰਿਆ ਜਾਂਦਾ ਸੀ ਅਤੇ ਉਹ ਇਕਦਮ ਨਵੇਂ ਨੌ ਲੱਗਦੇ ਸੀ ਉਹਨਾਂ ਨੂੰ ਬ ਪਰੋਲੇ ਨਾਲ ਬਾਉਂਡਰੀ ਕੀਤੀ ਜਾਂਦੀ ਸੀ ਇਸ ਲਈ ਇਹਨਾਂ ਸਾਰੀਆਂ ਕਲਾਤਮਕ ਜਿਹੜੀਆਂ ਚੀਜ਼ਾਂ ਨਾ ਉਹਨਾਂ ਦਾ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਧੰਨਵਾਦ